ਭੰਗੜਾ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਅਤੇ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਭੰਗੜਾ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਹੈ ਇਨ੍ਹਾਂ ਇਹ ਨਾ ਸਿਰਫ ਇੱਕ ਨਾਚ ਹੈ ਸਗੋਂ ਖੁਸ਼ੀ ਉਤਸ਼ਾਹ ਅਤੇ ਜੀਵਨ ਦੇ ਜਸ਼ਨ ਦਾ ਪ੍ਰਤੀਕ ਵੀ ਹੈ ਆਓ ਦੇਖਦੇ ਕਿ ਭੰਗੜਾ ਪੰਜਾਬੀ ਸੱਭਿਆਚਾਰ ਵਿੱਚ ਕਿਉਂ ਇੰਨਾ ਮਹੱਤਵਪੂਰਨ ਹੈ ਅਤੇ ਸਮੇਂ ਦੇ ਨਾਲ ਨਾਲ ਕਿਵੇਂ ਪੰਜਾਬੀ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ ਭੰਗੜੇ ਦੀ ਮਹੱਤਤਾ ਖੁਸ਼ੀ ਦਾ ਪ੍ਰਗਟਾਵਾ ਭੰਗੜਾ ਖੁਸ਼ੀ ਉਤਸ਼ਾਹ ਅਤੇ ਜੀਵਨ ਦੇ ਜਸ਼ਨ ਦਾ ਪ੍ਰਗਟਾਵਾ ਹੈ ਇਹ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਆਰਾਮ ਕਰਨ ਅਤੇ ਖੁਸ਼ੀ ਮਨਾਉਣ ਦਾ ਇੱਕ ਤਰੀਕਾ ਸੀ ਸੱਭਿਆਚਾਰ ਪਛਾਣ ਭੰਗੜਾ ਪੰਜਾਬ ਪੰਜਾਬੀ ਸੱਭਿਆਚਾਰ ਦੀ ਪਛਾਣ ਹੈ ਇਹ ਪੰਜਾਬ ਦੀ ਮਿਹਨਤ ਲਚਕਪਣ ਅਤੇ ਖੁਸ਼ੀ ਦੀ ਪ੍ਰਤੀਕ ਹੈ ਸਮਾਜਿਕ ਬੰਧਨ ਭੰਗੜਾ ਲੋਕਾਂ ਨੂੰ ਇਕੱਠਾ ਕਰਦਾ ਹੈ ਸਮਾਜਿਕ ਬੰਧਨ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਤਿਉਹਾਰਾਂ ਅਤੇ ਵਿਆਹਾਂ ਵਿੱਚ ਲੋਕਾਂ ਨੂੰ ਇੱਕ ਦੂਜੇ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ ਸਰੀਰ ਅਤੇ ਮਨ ਲਈ ਫਾਇਦੇਮੰਦ ਭੰਗੜਾ ਇੱਕ ਸਰੀਰਕ ਗਤੀਵਿਧੀ ਹੈ ਜੋ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਅਤੇ ਮਨ ਨੂੰ ਖੁਸ਼ ਰੱਖਦੀ ਹੈ ਪੰਜਾਬੀ ਸੰਗੀਤ ਦਾ ਪ੍ਰਚਾਰ ਭੰਗੜਾ ਪੰਜਾਬੀ ਸੰਗੀਤ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਭੰਗੜਾ ਅਤੇ ਪੰਜਾਬੀ ਤਿਉਹਾਰ ਭੰਗੜਾ ਹੁਣ ਪੰਜਾਬੀ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ ਲੋਕ ਵਿਸਾਖੀ ਦਿਵਾਲੀ ਲੋਹੜੀ ਅਤੇ ਹੋਰ ਤਿਉਹਾਰਾਂ ਦੌਰਾਨ ਭੰਗੜੇ ਦਾ ਆਨੰਦ ਲੈਂਦੇ ਹਨ ਭੰਗੜੇ ਨੇ ਨਾ ਸਿਰਫ ਪੰਜਾਬੀ ਸ ਵਿੱਚ ਸਗੋਂ ਦੁਨੀਆ ਭਰ ਵਿੱਚ ਪੰਜਾਬੀਆਂ ਨੂੰ ਇੱਕ ਇਕੱਠਾ ਕਰਨ ਵਿੱਚ ਮੱਹਤਵਪੂਰਨ ਭੂਮਿਕਾ ਨਿਭਾਈ ਹੈ ਸਿੱਟਾ ਭੰਗੜਾ ਪੰਜਾਬੀ ਸਭਿਆਚਾਰ ਦਾ ਇੱਕ ਅਨਮੋਲ ਖਜਾਨਾ ਹੈ ਇਹ ਖੁਸ਼ੀ ਉਤਸ਼ਾਹਿਤ ਅਤੇ ਜੀਵਨ ਦੇਖ ਜਾਂ ਜਸ਼ਨ ਦਾ ਪ੍ਰਤੀਕ ਹੈ ਭੰਗੜੇ ਨੇ ਸਮੇਂ ਦੇ ਨਾਲ ਪੰਜਾਬੀ ਤਿਉਹਾਰਾਂ ਦਾ ਅਨਿੱਖੜਵਾਂ ਅੰਗ ਬਣਾ ਕੇ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਕੀਤਾ ਹੈ ਕੀ ਤੁਸੀਂ ਭੰਗੜੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਭੰਗੜੇ ਦੇ ਵੱਖ ਵੱਖ ਅੰਦੋਲਨਾਂ ਬਾਰੇ ਭੰਗੜੇ ਦੇ ਇਤਿਹਾਸ ਬਾਰੇ ਭੰਗੜੇ ਦੀ ਪ੍ਰਸਿੱਧ ਰੀਤੀ ਬਾਰੇ ਭੰਗੜੇ ਨੂੰ ਸਿੱਖਾਂ ਦੇ ਤਰੀਕੇ ਬਾਰੇ ਤੁਸੀਂ ਮੈਨੂੰ ਕੋਈ ਵੀ ਸਵਾਲ ਪੁੱਛਣ ਪੁੱਛ ਸਕਦੇ ਹੋ